ਕਿਸਾਨਾਂ ਦੀ ਖੁਦਕੁਸ਼ੀ ਬਾਰੇ ਮੇਰਾ ਇਹ ਵਿਚਾਰ ਹੈ ਕਿ ਜਦੋਂ ਵੀ ਕਿਸਾਨ ਖੇਤੀ ਕਰਦਾ ਹੈ ਤਾਂ ਉਹ ਬੈਂਕ ਅਤੇ ਜਾਂ ਕਿਸੇ ਬੰਦੇ ਤੋਂ ਲੋਨ ਲੈ ਕੇ ਖੇਤੀ ਕਰਦਾ ਹੈ ਅਤੇ ਖੇਤੀ ਵਿੱਚ ਬੀਜ ਬੀਜਦਾ ਹੈ ਉਹ ਕਈ ਤਰ੍ਹਾਂ ਦੀ ਖੇਤੀ ਕਰਦਾ ਹੈ ਜਿਵੇਂ ਕਿ ਕਣਕਾਂ ਬੀਜਦਾ ਹੈ ਅਤੇ ਝੋਨਾ ਲਾਉਂਦਾ ਹੈ ਜਦੋਂ ਵੀ ਕਣਕਾਂ ਬੀਜਦਾ ਕਣਕਾਂ ਜਦੋਂ ਪੱਕ ਜਾਂਦੀਆਂ ਹਨ ਜਦੋਂ ਵਢਾਈ ਜਾਂ ਕਟਾਈ ਹੁੰਦੀ ਹੈ ਜੇਕਰ ਭਾਰੀ ਵਰਖਾ ਹੋ ਜਾਵੇ ਤਾਂ ਉਸ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਅਤੇ ਉਸ ਨੂੰ ਲੋਨ ਉਤਾਰਨਾ ਜਾਂ ਬਹੁਤ ਸਾਰੀਆਂ ਚੀਜ਼ਾਂ ਦਾ ਘਾਟਾ ਪੈ ਜਾਂਦਾ ਹੈ ਲੋਨ ਉਤਾਰਨਾ ਉਸ ਲਈ ਬਹੁਤ ਔਖਾ ਹੋ ਜਾਂਦਾ ਹੈ ਉਸਨੇ ਘਰ ਵੀ ਦੇਖਣਾ ਹੁੰਦਾ ਹੈ ਜਿਸ ਕਾਰਨ ਉਹ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਂਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਬਿਜਲੀ ਅਤੇ ਪਾਣੀ ਥੋੜ੍ਹਾ ਫ੍ਰੀ ਕੀਤਾ ਜਾਵੇ ਅਤੇ ਟਰੈਕਟਰ ਦੀ ਵੀ ਸੇਵਾ ਥੋੜ੍ਹੀ ਉਹਨਾਂ ਨੂੰ ਫ੍ਰੀ ਕੀਤੀ ਜਾਵੇ ਉਹਨਾਂ ਨੂੰ ਉਹਨਾਂ ਦੀ ਪੈਲੀ ਵੀ ਖੋਹ ਲਈ ਜਾਂਦੀ ਹੈ ਕਈ ਵਾਰ ਤਾਂ ਪੈਸੇ ਨਾ ਚੁਕਾ ਸਕਣ ਤਾਂ ਉਹਨਾਂ ਤੋਂ ਉਹਨਾਂ ਦੀ ਪੈਲੀ ਖੋਹ ਲਈ ਜਾਂਦੀ ਹੈ ਇਸ ਕਰਕੇ ਕਿਸਾਨ ਖੁਦਕੁਸ਼ੀ ਕਰਦਾ ਹੈ ਧੰਨਵਾਦ